ਸਾਰੇ ਹੀ ਧਰਮ ਸਾਨੂੰ ਆਪਸ ਵਿੱਚ ਮਿਲ ਕੇ ਚੱਲਣ ਦੀ ਸਿੱਖਿਆ ਅਤੇ ਉਪਦੇਸ਼ ਦਿੰਦੇ ਹਨ ਅਤੇ ਆਪਸੀ ਭਾਈਚਾਰਾ ਕਾਇਮ ਕਰਨ ਦੀ ਸਿੱਖਿਆ ਦਿੰਦੇ ਹਨ ਜੇਕਰ ਮੈਂ ਆਪਣੀ ਗੱਲ ਕਰਾਂ ਤਾਂ ਮੈਨੂੰ ਹਿੰਦੂ ਧਰਮ ਦੇ ਲੋਕ ਕਾਫੀ ਆਕਰਸ਼ਿਤ ਕਰਦੇ ਹਨ ਕਿਉਂਕਿ ਬਚਪਨ ਤੋਂ ਹੀ ਸਕੂਲੀ ਸਕੂਲ ਦੇ ਸਮੇਂ ਹੀ ਮੇਰੇ ਨਾਲ ਮੇਰੇ ਕੁਝ ਦੋਸਤ ਹਿੰਦੂ ਸਨ ਅਤੇ ਇਸ ਤੋਂ ਇਲਾਵਾ ਹੁਣ ਮੌਜੂਦਾ ਸਮੇਂ ਵਿੱਚ ਵੀ ਦਫ਼ਤਰ ਵਿੱਚ ਵੀ ਮੇਰੇ ਹਿੰਦੂ ਭਾਈਚਾਰੇ ਦੇ ਸਹਿਕਰਮੀ ਹਨ ਅਤੇ ਉਹ ਕਰਮਚਾਰੀਆਂ ਵੱਲੋਂ ਵੀ ਜਿਸ ਤਰ੍ਹਾਂ ਨਰਾਤਿਆਂ ਵਿੱਚ ਉਸ ਈਸ਼ਵਰ ਦੀ ਭਗਤੀ ਅਤੇ ਅਰਾਧਨਾ ਕੀਤੀ ਜਾਂਦੀ ਹਨ ਅਤੇ ਵਰਤ ਆਦਿ ਰੱਖੇ ਜਾਂਦੇ ਹਨ ਮੇਰੇ ਵੱਲੋਂ ਉਹਨਾਂ ਦੀ ਆਪਣੇ ਪ੍ਰਭੂ ਪਰਮਾਤਮਾ ਪ੍ਰਤੀ ਇਸ਼ਟਾ ਅਤੇ ਸ਼ਰਧਾ ਦੇਖ ਕੇ ਮਨ ਬਹੁਤ ਪ੍ਰਸੰਨ ਹੁੰਦਾ ਹੈ ਅਤੇ ਉਹਨਾਂ ਵੱਲੋਂ ਜਿਸ ਤਰ੍ਹਾਂ ਜਾਗਰਨ ਆਦਿ ਦੇ ਸਮੇਂ ਵੀ ਵੀ ਮੈਨੂੰ ਸੱਦਾ ਪੱਤਰ ਦਿੱਤਾ ਜਾਂਦਾ ਹੈ ਤਾਂ ਮੈਂ ਉਸ ਵਿੱਚ ਵੀ ਸ਼ਾਮਿਲ ਹੋ ਕੇ ਉਹਨਾਂ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੁੰਦਾ ਹਾਂ ਅਤੇ ਇਸ ਨਾਲ ਮੇਰੇ ਮਨ ਨੂੰ ਵੀ ਕਾਫੀ ਸ਼ਾਂਤੀ ਮਿਲਦੀ ਹੈ